ਹੈਲੋ

ਹਾਂਜੀ ਹਾਂਜੀ ਹਾਂਜੀ ਹਾਂਜੀ ਦੱਸੋ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਬਹੁਤ ਵਧੀਆ ਤੁਸੀਂ ਸੁਣਾਓ ਹਾਂਜੀ ਹਾਂਜੀ ਤੁਸੀਂ ਪਰਿਵਾਰ ਸਮੇਤ ਜਾਣਾ ਜੀ ਅੱਛਾ ਜੀ ਬੱਚੇ ਨੇ ਪੰਜ ਜਾਣੇ ਹੋ ਤੁਸੀਂ ਤੋਂ ਤੁਹਾਨੂੰ ਸਭ ਤੋਂ ਵਧੀਆ ਠੀਕ ਰਹੇਗਾ ਜੀ ਜੰਮੂ ਕਸ਼ਮੀਰ ਵਾਲਾ ਏ ਏਰੀਆ ਜਿਹੜਾ ਹੈਗਾ ਇੱਥੋਂ ਉਹਦੇ 'ਚ ਤੁਹਾਨੂੰ ਮੈਂ ਦੱਸਦਾ ਤੁਸੀਂ ਇੱਥੋਂ ਜਾਓਂਗੇ ਤਾਂ ਇਹ ਇੱਕ ਤਾਂ ਉੱਥੇ ਬੜੇ ਸੋਹਣੇ ਵਾਤਾਵਰਨ ਬਹੁਤ ਵਧੀਆ ਸਫਾਈ ਆ ਸਾਰਾ ਬਹੁਤ ਵਧੀਆ ਹੈਗਾ ਅਤੇ ਰੇਟ ਵੀ ਉੱਥੇ ਵਾਜਬ ਨੇ ਮੈਂ ਤੁਹਾਨੂੰ ਬੰਦਿਆਂ ਦੇ ਨਾਂ ਦੱਸ ਦੂੰਗਾ ਹੋਟਲ ਵਾਲਿਆਂ ਦੇ ਜਾਂ ਹੋਰ ਉਹ ਫਿਰ ਤੁਹਾਨੂੰ ਰੇਟ ਸਹੀ ਲਾ ਦਿੰਦੇ ਨੇ ਕਈ ਵਾਰ ਨਵੇਂ ਬੰਦੇ ਨੂੰ ਥੋੜ੍ਹਾ ਜਿਹਾ ਰੇਟ ਵੀ ਉਹ ਜ਼ਿਆਦੇ ਲਾ ਦਿੰਦੇ ਨੇ ਜਿਵੇਂ ਤੁਸੀਂ ਹੁਣ ਇ ਇੱਥੋਂ ਜਾਓਗੇ ਪਠਾਣਕੋਟ ਟੱਪ ਕੇ ਸਭ ਤੋਂ ਪਹਿਲੀ ਰਾਤ ਤੁਸੀਂ ਪਤਨੀਟੋਪ ਰੁਕਣਾ ਜੀ ਉੱਥੇ ਆਪਣੇ ਹੈਗਾ ਏ ਸਨਰਾਈਜ਼ ਹੋਟਲ ਵਾਲੇ

ਬਸ ਠੀਕ ਆ ਜੀ ਠੀਕ ਆ ਠੀਕ ਆ ਤੁਹਾਡਾ ਉੱਥੇ ਕਰਾ ਦਾਂਗੇ ਬੁੱਕ ਉਹ ਤੋਂ ਬਾਅਦ ਫਿਰ ਅੱਗੇ ਉਹ ਪਹਿਲਗਾਮ ਹੈਗਾ ਉੱਥੇ ਆਪਣੇ ਗੁੱਲਮਾਰਗ ਹੈਗਾ ਜੀ ਸ਼੍ਰੀਨਗਰ ਦੇ ਡੱਲ ਝੀਲ ਆ ਉੱਥੇ ਡੱਲ ਝੀਲ ਉਹਦੇ ਬਾਰੇ ਵੀ ਤੁਹਾਨੂੰ ਸਾਰਾ ਗਾਈਡੈਸ ਕਰ ਦਾਂਗੇ ਅਤੇ ਬਾਹਲੇ ਰੇਟ ਨਹੀਂ ਤੁਹਾਨੂੰ ਲਾਉਣਗੇ ਤੁਸੀਂ ਮੈਨੂੰ ਮਿਲ ਲਿਓ ਜਦ ਮਰਜੀ ਮੇਰਾ ਨੰਬਰ ਹੈਗਾ ਤੁਹਾਡੇ ਕੋਲ ਜਦੋਂ ਵੀ ਤੁਹਾਡਾ ਟਾਈਮ ਮਿਲਦਾ ਮੈਨੂੰ ਫੋਨ ਕਰ ਲਿਓ ਗੱਡੀ ਅਰੇਟੀਕਾ ਨਹੀਂ ਪੰਜ ਬ ਪੰਜ ਬੰਦੇ ਹੋ ਤੁਸੀਂ ਤੁਹਾਨੂੰ ਅਰੀਟਿਕਾ ਗੱਡੀ ਬਹੁਤ ਠੀਕ ਰਹੂਗੀ ਰੇਟ ਵੀ ਤੁਹਾਨੂੰ ਜਾਇਜ਼ ਕਰਾ ਦਾਂਗੇ ਆਪਣੇ ਕੋਲ ਗੱਡੀਆਂ ਹੈਗੀਆਂ ਸਾਰੀਆਂ ਪਿਕਅੱਪ ਵਧੀਆ ਵਧੀਆ ਗੱਡੀਆਂ ਨੇ ਅੰਦਾਜਾ ਐਂ ਆ ਜੀ ਵੀ ਚਾਹੇ ਤਾਂ ਤੁਸੀਂ ਦਿਹਾੜੀ 'ਤੇ ਲੈ ਜਿਓ ਤੁਹਾਨੂੰ ਦੋ ਹਜ਼ਾਰ ਦਿਹਾੜੀ ਚੱਲਦੀ ਆ ਤੁਹਾਨੂੰ ਸਤਾਰ੍ਹਾਂ ਸੌ ਲਾ ਦਾਂਗੇ ਅਸੀਂ ਦਿਹਾੜੀ ਦਾ ਚੌਵੀ ਘੰਟੇ ਦਾ ਅਤੇ ਉਹ ਕਿੰਨੇ ਦਿਨ ਰਹੋਂਗੇ ਤੁਸੀਂ ਉੱਥੇ ਪੰਜ ਜਾਂ ਛੇ ਦਿਨ ਪੰਜ ਦਿਨ ਫਿਰ ਤੁਹਾਡਾ ਤੁਸੀਂ ਜਾਂ ਤਾਂ ਐਂ ਕਰਿਓ ਜੀ ਰੁਪਈਆ ਸੱਤ ਹਜ਼ਾਰ ਦੇ ਦਿਓ ਜਾਂ ਡੀਜਲ ਫੁੱਲ ਕਰਾ ਕੇ ਦੇਵਾਂਗੇ ਡੀਜਲ ਫੁੱਲ ਕਰਾ ਕੇ ਦੇ ਦਿਓ ਜੇ ਡੀਜ਼ਲ ਵੀ ਨਹੀਂ ਪਵਾਉਣਾ ਹੈਗਾ ਫਿਰ ਤੁਸੀਂ ਸਾਨੂੰ ਉੱਕਾ ਪੁੱਕਾ ਦੇ ਦਿਓ ਜੀ ਚੌਦ੍ਹਾਂ ਹਜ਼ਾਰ ਰੁਪਿਆ ਹਾਂ ਜੀ ਮੈਨੂੰ ਦੱਸ ਦਿਓ ਫਿਰ ਦਫਤਰ ਆ ਜਿਓ ਆਪਣੇ ਦਫਤਰ ਦਾ ਕਾਰਡ ਹੈ ਮੈਂ ਤੁਹਾਨੂੰ ਦੇ ਦਿੰਦਾ ਲੈ ਜਿਓ ਅਤੇ ਆ ਜਿਓ ਹਾਂ ਜੀ ਮੈਂ ਕਰ ਦਿੰਨਾਂ ਠੀਕ ਆ ਜੀ ਐਸੇ ਐਸੇ ਨੰਬਰ 'ਤੇ ਚਲਦਾ ਵੱਟਸਐਪ ਤੁਹਾਡਾ ਮੈਂ ਕਰਦਾਂ ਜੀ ਕਰ ਕਰ ਦਿੰਦਾ ਠੀਕ ਆ ਧੰਨਵਾਦ ਓਕੇ ਓਕੇ ਓਕੇ